ਹੈਲੋ ਨਮਸਤੇ ਦੀਦੀ ਹੋਰ ਕੀ ਹਾਲ ਚਾਲ ਜੇ ਹਾਂਜੀ ਏ ਮਤਲਬ ਕਿ ਰੋਈ ਨਾ ਉੱਥੇ ਕੋਈ ਮਤਲਬ ਕਿ ਪਾਰ ਪਾਰਕ ਵਗੈਰਾ ਹੈਗੇ ਹੈ ਅੱਛਾ ਅੱਛਾ ਅਤੇ ਮਤਲਬ ਕਿ ਬਗੀਚੇ ਵਗੈਰਾ ਅੱਛਾ ਅੱਛਾ ਹਾਂ ਠੀਕ ਹੈ ਹਾਂ ਮਤਲਬ ਕਿ ਔਕਸੀਜਨ ਵਗੈਰਾ ਫੁੱਲ ਮਿਲਦੀ ਉੱਥੇ ਹਾਂ ਹਾਂ ਹਾਂਜੀ ਹੋਰ ਅੱਛਾ ਅੱਛਾ ਅਤੇ ਹੋਰ ਪਾਰਕ ਵਗੈਰਾ ਕੋਈ ਹੋਰ ਵਧੀਆ ਨਹੀਂ ਹੈਗੇ ਜਿੱਥੇ ਮਤਲਬ ਕਿ ਨਾਲ ਹੀ ਬਗੀਚੇ ਵਗੈਰਾ ਵੋਕਿੰਗ ਵਗੈਰਾ ਹੋਏ ਹਾਂਜੀ ਹਾਂਜੀ

ਠੀਕ ਹੈ ਠੀਕ ਹੈ ਹਰ ਤਰ੍ਹਾਂ ਦੇ ਫਲਾਵਰ ਹੋਣਗੇ ਨਾ ਉੱਥੇ ਹਾਂ ਠੀਕ ਅੱਛਾ ਅੱਛਾ ਮਤਲਬ ਕਿ ਸ਼ਾਮ ਨੂੰ ਲੋਕ ਚਲ ਜਾਂਦੇ ਹੋਣੇ ਆ ਨਾ ਠੀਕ ਹੈ ਠੀਕ ਹੈ ਠੀਕ ਹੈ ਹੋਰ ਅੱਛਾ ਅੱਛਾ ਅੱਛਾ ਅਤੇ ਉੱਥੇ ਮਤਲਬ ਕਿ ਜਿਮ ਵਗੈਰਾ ਵਾਲੇ ਲੱਗੇ ਵੇ ਹੈ ਮਤਲਬ ਵੋਕਿੰਗ ਵਾਸਤੇ ਹਾਂ ਜਿੱਦਾਂ ਐਕਸਰਸਾਈਜ਼ ਵਗੈਰਾ ਐਕਸਰਸਾਈਜ਼ ਵਗੈਰਾ ਵੀ ਕਰ ਸਕਦੇ ਉੱਥੇ ਲੋਕ ਹਾਂਜੀ ਹਾਂਜੀ ਹੋਰ ਹਾਂਜੀ ਹਾਂਜੀ ਜ਼ਰੂਰ ਨਹੀਂ ਹਾਲੇ ਨਹੀਂ ਪਹੁੰਚੇ ਹੈਗੇ ਪਹੁੰਚਣ ਵਾਲੇ ਮੈਂ ਕਿਹਾ ਚਲੋ ਕੋਲ ਕਰਕੇ ਪੁੱਛ ਲੈਂਦੇ ਹਾਂ ਤਾਂ ਕਰਕੇ ਮੈਂ ਕਿਹਾ ਚਲੋ ਹਾਂ ਹਾਂ ਹਾਂ ਅੱਛਾ ਠੀਕ ਹੈ ਹਾਂ ਬਾਕੀ ਉਹਨਾਂ ਨੇ ਉਹ ਮਤਲਬ ਕਿ ਪੌਦੇ ਵਗੈਰਾ ਕਿ ਲਗਾਏ ਵੇ ਹੈ ਕਿ ਉਹ ਫਰੁ ਸਬਜ਼ੀਆਂ ਵਗੈਰਾ ਵੀ ਲਾਈ ਵੀਆਂ ਅੱਛਾ ਅੱਛਾ ਠੀਕ ਆ ਠੀਕ ਓਕੇ ਓਕੇ ਜੀ ਓਕੇ